ਜਿਵੇਂ ਕਿ ਅਸੀਂ ਜਾਣਦੇ ਹਾਂ ਅੰਗਰੇਜ਼ੀ ਦਾ ਦੌਰ ਆ ਗਿਆ ਹੈ ਅਤੇ ਅੰਗਰੇਜ਼ੀ ਦੇ ਇਸ ਦੌਰ ਵਿੱਚ ਐਨੀ ਭੱਜ ਦੌੜ ਮੱਚ ਗਈ ਹੈ ਹਰ ਇੱਕ ਨੂੰ ਅੰਗਰੇਜ਼ੀ ਦੀ ਅੰਗਰੇਜ਼ੀ ਸਿੱਖਣ ਦੀ ਕਾਹਲ ਲੱਗੀ ਹੈ ਇਸ ਕਰਕੇ ਉਹ ਆਪਣੀ ਜਿਹੜੀ ਪਿਛੋਕੜ ਭਾਸ਼ਾ ਪੰਜਾਬੀ ਹੈ ਉਸਨੂੰ ਭੁੱਲਦਾ ਜਾ ਰਿਹਾ ਹੈ ਇਸ ਨੂੰ ਅੱਗੇ ਵਧਾਉਣ ਲਈ ਜਾਂ ਇਸ ਨੂੰ ਸੁਰੱਖਿਅਤ ਰੱਖਣ ਲਈ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਹ ਆਪਣੇ ਮੁੱਢਲੇ ਪਿੰਡ ਪੰਜਾਬ ਤੋਂ ਜੁੜਿਆ ਰਹੇ ਅਤੇ ਨਾਲ ਹੀ ਉਸਦੇ ਆਪਣੀ ਭਾਸ਼ਾ ਨੂੰ ਨਾ ਭੁੱਲੇ ਆਪਣੇ ਘਰ ਪਰਿਵਾਰ ਦੇ ਨਾਲ ਆਪਣੀ ਭਾਸ਼ਾ ਦੇ ਵਿੱਚ ਗੱਲਬਾਤ ਕਰਦਾ ਰਹੇ ਅਤੇ ਇਸ ਤੋਂ ਇਲਾਵਾ ਉਹ ਆਪਣੇ ਬੱਚਿਆਂ ਨੂੰ ਵੀ ਅੱਗੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਫਾਇਦੇ ਦੱਸਣ ਤਾਂ ਕਿ ਆਪਣਾ ਆਪਣੀ ਜਿਹੜੀ ਪਰੰਪਰਾ ਹੈਗੀ ਹੈ ਉਹ ਅੱਗੇ ਵੱਧਦੀ ਫੁੱਲਦੀ ਰਹੇ ਅਤੇ ਆਪਣਾ ਵੀ ਪਿਛੋਕੜ ਜਿਹੜਾ ਹੈਗਾ ਉਹ ਸਟਰੋਂਗ ਬਣੇ ਨਹੀਂ ਤਾਂ ਅਸੀਂ ਦੂਜਿਆਂ ਦੇ ਪਿਛੋਕੜ ਦੇ ਉੱਤੇ ਅਧਾਰਿਤ ਰਹਾਂਗੇ ਅਤੇ ਆਪ ਦਾ ਪਿਛੋਕੜ ਜਿਹੜਾ ਹੈ ਉਹ ਸਾਰਾ ਪਿੱਛੇ ਛੁੱਟ ਜਾਊਗਾ